ਸਥਾਨਕ ਕਲਾਕਾਰ ਆਪਣੇ ਸਥਾਨ ਅਤੇ ਰਾਜ ਦੀ ਕਲਾ ਦੇ ਸੱਭਿਆਚਾਰ ਨੂੰ ਕਦੇ ਵੀ ਖ਼ਰਾਬ ਨਹੀਂ ਹੋਣ ਦਿੰਦੇ ਅਤੇ ਉਹਨਾਂ ਨੂੰ ਹਮੇਸ਼ਾ ਹੀ ਸੰਭਾਲ ਕੇ ਰੱਖਦੇ ਹੈ ਉਹ ਹਮੇਸ਼ਾ ਚਾਹੁੰਦੇ ਹੈ ਵੀ ਉਹਨਾਂ ਦੀ ਸੁਰੱਖਿਆ ਰੱਖਣ ਦੀ ਕੋਸ਼ਿਸ਼ ਕਰਦੇ ਹੈ ਤਾਂ ਕਿ ਸੱਭਿਆਚਾਰ ਸਮੁੱਚੇ ਤੌਰ 'ਤੇ ਸੁਰੱਖਿਆ ਰੱਖਣ ਦੀ ਕੋਸ਼ਿਸ਼ ਕਰ